ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਅੱਛਾ ਜੀ ਉਹ ਹਾਂਜੀ ਉਹ ਕੀ ਨਸ਼ਾ ਕਰਦੇ ਨੇ ਜੀ ਅੱਛਾ ਜੀ ਕੋਈ ਨਾ ਜੀ ਇੱਕ ਵਾਰ ਤੁਸੀਂ ਲੈ ਕੇ ਆ ਸਕਦੇ ਹੋ ਹੋਸਪੀਟਲ 'ਚ ਜੀ ਨਹੀਂ ਜੀ ਇੱਦਾਂ ਨਹੀਂ ਦੇ ਸਕਦੇ ਜੀ ਅਸੀਂ ਸਾਨੂੰ ਅਲੋਡ ਨਹੀਂ ਕੀਤਾ ਹੋਇਆ ਜੀ ਸਰਕਾਰ ਵੱਲੋਂ ਤਾਂ ਤੁਹਾਨੂੰ ਇੱਕ ਵਾਰ ਲਿਓ ਲਿਆਉਣਾ ਹੀ ਪਊਗਾ ਜੀ ਇੱਥੇ ਹਾਂਜੀ ਬਿਨਾਂ ਦੇ ਕੋਈ ਨਾ ਜੀ ਦੱਸ ਦਿੰਦੇ ਹਾਂ ਪਰ ਇੱਕ ਵਾਰ ਤੁਹਾਨੂੰ ਇੱਥੇ ਲਿਆਉਣਾ ਹੀ ਪਊਗਾ ਜੀ ਜ਼ਰੂਰ ਹਾਂ ਕਿਉਂਕਿ ਬਿਨਾਂ ਦੱਸੇ ਦਵਾਈ ਦੇ ਨਹੀਂ ਸਕਦੇ ਅਸੀਂ ਸਾਨੂੰ ਮਤਲਬ ਪਰਮਿਸ਼ਨ ਨਹੀਂ ਹੈਗੀ ਜੀ ਸਰਕਾਰ ਵੱਲੋਂ ਹਾਂਜੀ ਫੀਸ ਕੋਈ ਨਾ ਜੀ ਦੇਖ ਕੇ ਦੱਸ ਦਾਂਗੇ ਜੀ ਉਹ ਤਾਂ ਜੀ ਉਹਨਾਂ ਦੀ ਕੰਡੀਸ਼ਨ ਦੇਖ ਕੇ ਦੱਸ ਸਕਦੇ ਵੀ ਉਹਨਾਂ ਨੂੰ ਜ਼ਿਆਦਾ ਨਸ਼ਾ ਲੱਗ ਹੋਇਆ ਜਾਂ ਘੱਟ ਮਤਲਬ ਕਿੰਨੇ ਟਾਈਮ ਦੇ ਉਹਨਾਂ ਦੇ ਨਸ਼ੇ ਦੀ ਮਤਲਬ ਲੱਤ ਲੱਗੀ ਹੋਈ ਆ ਉਹਨਾਂ ਦਾ ਅਸੀਂ ਦੱਸ ਦਾਂਗੇ ਉਹ ਤਾਂ ਹਾਂਜੀ ਕਦੋਂ ਆਉਣਾ ਜੀ ਫਿਰ ਠੀਕ ਹੈ ਜੀ ਨਹੀਂ ਕੋਈ ਨਾ ਜੀ ਅਪੋਆਇੰਟਮੈਂਟ ਲੈ ਕੇ ਆ ਜਿਓ ਇੱਕ ਵਾਰ ਕੌਲ ਜਰੂਰ ਕਰ ਲਿਓ ਜੀ ਹਾਂਜੀ ਠੀਕ ਓਕੇ ਜੀ